ਕੱਪੜੇ ਧੋਣ ਦੇ ਬਹੁਤ ਸਾਰੇ ਤਰੀਕੇ ਹਨ ਜਿਵੇਂ ਕਿ ਮਸ਼ੀਨ ਫੁੱਲੀ ਆਟੋਮੈਟਿਕ ਮਸ਼ੀਨ ਰਾਹੀਂ ਵੀ ਕੱਪੜੇ ਧੁੱਲ੍ਹੇ ਜਾ ਸਕਦੇ ਹਨ ਸੈਮੀ ਆਟੋਮੈਟਿਕ ਮਸ਼ੀਨ ਦੇ ਨਾਲ ਵੀ ਕੱਪੜੇ ਧੋਏ ਜਾ ਸਕਦੇ ਆ ਅਤੇ ਹੱਥਾਂ ਦੇ ਨਾਲ ਵੀ ਧੋਏ ਜਾ ਸਕਦੇ ਆ ਮੈਂ ਇਹਨਾਂ ਤਿੰਨਾਂ ਚੀਜ਼ਾਂ ਦਾ ਇਸਤੇਮਾਲ ਕਰਦਾ ਹਾਂ ਕਿਉਂਕਿ ਮੇਰੇ ਲਵੇ ਇੱਕ ਫੁੱਲੀ ਆਟੋਮੈਟਿਕ ਐੱਲ ਜੀ ਦੀ ਫਰੰਟ ਲੋਡ ਮਸ਼ੀਨ ਹੈ ਅਤੇ ਜਿਸਦਾ ਕੁੱਲ ਵਜ ਜਿਹੜਾ ਵਜ਼ਨ ਧੋ ਸਕਦੀ ਹੈ ਉਹ ਨੌ ਕਿੱਲੋ ਹੈ ਮੇਰੇ ਲਵੇ ਇੱਕ ਸੈਮੀ ਆਟੋਮੈਟਿਕ ਐੱਲ ਜੀ ਦੀ ਮਸ਼ੀਨ ਹੈ ਜਿਹਦਾ ਧੋੋਣ ਵਜ਼ਨ ਉਹ ਸਾਢੇ ਨੌ ਕਿੱਲੋ ਧੋ ਸਕਦੀ ਹੈ ਅਤੇ ਮੈਨੂੰ ਹੱਥਾਂ ਦੇ ਨਾਲ ਕੱਪੜੇ ਧੋਣੇ ਵੀ ਆਉਂਦੇ ਹਨ ਅਤੇ ਮੇਰੇ ਘਰ ਦੇ ਪਿੱਛੇ ਇੱਕ ਵੱਡਾ ਸਾਰਾ ਸ਼ੈੱਡ ਲੱਗਿਆ ਹੋਇਆ ਹੈ ਜਿਸਦੇ ਥੱਲੇ ਆਪਣੇ ਕੱਪੜੇ ਸੁਕਾਉਣ ਦੇ ਲਈ ਤਾਰਾਂ ਵੀ ਵਿਛੀ ਲੱਗੀਆਂ ਹੋਈਆਂ ਹਨ ਜਿਹੜੇ ਮੈਂ ਕੱਪੜੇ ਧੋ ਕੇ ਆਪਣੇ ਉਸਦੇ ਉੱਤੇ ਤਾਰਾਂ ਉੱਤੇ ਸੁਕਾ ਦਿੰਦਾ ਹਾਂ ਸ਼ੈੱਡ ਹੋਣ ਕਰਕੇ ਉੱਥੇ ਧੁੱਪ ਇੰਨੀ ਜ਼ਿਆਦਾ ਤਾਂ ਨਹੀਂ ਆਉਂਦੀ ਨਾ ਮੀਂਹ ਉੱਥੇ ਆਉਂਦਾ ਹੈ ਧੁੱਪ ਨਾ ਆਉਣ ਕਰਕੇ ਉਹ ਕੱਪੜੇ ਥੋੜ੍ਹੀ ਲੇਟ ਹੀ ਸੁੱਕਦੇ ਹਨ ਅਤੇ ਅਤੇ ਨਾਲ ਦੀ ਨਾਲ ਉਹ ਥੋੜ੍ਹਾ ਟਾਈਮ ਲੈ ਕੇ ਹੀ ਤਿਆਰ ਹੋ ਸਕਦੇ ਹਨ ਕੱਪੜੇ ਪਰ ਜਦੋਂ ਮੀਂਹ ਪੈਂਦਾ ਹੈ ਉਸ ਚੀਜ਼ ਦਾ ਮੈਨੂੰ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਜਿਸਦੇ ਕਾਰਨ ਮੇਰੇ ਕੱਪੜੇ ਗਿੱਲੇ ਵੀ ਨਹੀਂ ਹੁੰਦੇ ਅਤੇ ਨਾਲ ਦੀ ਨਾਲ ਮੈਂ ਆਪਣੇ ਹੋ ਸਕੇ ਤਾਂ ਹੋਰ ਵੀ ਕੱਪੜੇ ਜ਼ਿਆਦਾ ਧੋ ਕੇ ਉੱਥੇ ਮੈਂ ਸੁਕਾ ਸਕਦਾ ਹਾਂ ਜਿਹੜੀ ਕਿ ਸੈਮੀ ਆਟੋਮੈਟੀਕਲੀ ਮਸ਼ੀਨ ਹੈ ਉਸਦੇ ਕਾਰਨ ਕੀ ਹੈ ਮੈਂ ਆਪਣੇ ਜਿਹੜੇ ਜ਼ਿਆਦਾ ਮੋਟੇ ਕੱਪੜੇ ਹਨ ਜਾਂ ਜਿਹੜੇ ਕੱਪੜੇ ਜ਼ਿਆਦਾ ਲਫ ਸਕਦੇ ਹਨ ਉਹ ਮੈਂ ਆਪਣੇ ਹੱਥਾਂ ਅਤੇ ਨਾ ਜਾਂ ਫਿਰ ਸੈਮੀ ਆਟੋਮੈਟਿਕ ਮਸ਼ੀਨ ਦੇ ਨਾਲ ਧੋਂਦਾ ਹਾਂ ਜਿਹੜੇ ਮੇਰੇ ਰੋਜ਼ਾਨਾ ਕੱਪੜੇ ਪਾਏ ਜਾਂਦੇ ਹਨ ਜਾਂ ਫਿਰ ਮੇਰੇ ਕੋਈ ਜ਼ਰੂਰੀ ਕੱਪੜੇ ਹਨ ਉਹ ਮੈਂ ਫੁੱਲੀ ਆਟੋਮੈਟਿਕ ਮਸ਼ੀਨ ਦੇ ਵਿੱ ਨਾਲ ਇੱਕ ਘੰਟੇ ਦੇ ਵਿੱਚ ਧੋ ਕੇ ਉਹ ਮੈਂ ਤਿਆਰ ਕਰਾ ਲੈਂਦਾ ਹਾਂ ਜਿਹੜੇ ਉਹ ਮਸ਼ੀਨ ਦੇ ਵਿੱਚ ਕੱਪੜੇ ਧੁੱਲਦੇ ਹਨ ਉਹ ਸੁੱਕੇ ਸੁਕਾਏ ਹੀ ਬਾਹਰ ਨਿਕਲਦੇ ਹਨ ਜਿਸਦੇ ਕਾਰਨ ਕੀ ਹੈ ਉਹਨਾਂ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਤਿਆਰ ਹੋਣ ਦੇ ਲਈ ਜਿਸਦੇ ਕਾਰਨ ਕੀ ਹੈ ਮੈਂ ਉਹ ਕੱਪੜੇ ਅੱਧੇ ਘੰਟੇ ਦੇ ਵਿੱਚ ਹੀ ਪਾ ਸਕਦਾ ਹਾਂ ਅਤੇ ਜਿਸਦੇ ਕਾਰਨ ਉਹ ਮੈਨੂੰ ਬਹੁਤ ਫਾਇਦਾ ਦਿੰਦਾ ਹੈ ਜਿਹੜੇ ਮੇਰੇ ਕੱਪੜੇ ਰੋਜ਼ਾਨਾ ਪੈਂਦੇ ਨੇ ਉਹੀ ਕੱਪੜਿਆਂ ਮੈਂ ਉਹਦੇ ਵਿੱਚ ਧੋਂਦਾ ਹਾਂ ਜਾਂ ਫਿਰ ਜਿਹੜੇ ਕੱਪੜੇ ਮੇਰੇ ਸੀਜ਼ਨਲ ਹੁੰਦੇ ਹਨ ਜਾਂ ਫਿਰ ਮੈਂ ਆਪਣੇ ਇੱਕ ਵਾਰ ਹੱਥਾਂ ਦੇ ਨਾਲ ਧੋਣ ਦੇ ਇਛੁੱਕ ਹਾਂ ਉਹ ਮੈਂ ਹੱਥਾਂ ਨਾਲ ਜਾਂ ਫਿਰ ਸੈਮੀ ਆਟੋਮੈਟਿਕ ਮਸ਼ੀਨ ਦੇ ਨਾਲ ਹੀ ਧੋਂਦਾ ਹਾਂ ਜਿਸਦੇ ਕਾਰਨ ਹੀ ਮੈਂ ਮੈਂ ਆਪਣਾ ਵਧੀਆ ਗੁਜ਼ਾਰਾ ਕਰ ਪਾ ਰਿਹਾ ਹਾਂ ਜਦੋਂ ਕਿ ਜਦੋਂ ਕਿ ਮੈਨੂੰ ਬਾਹਰ ਕਿਤੇ ਜਾਣਾ ਪੈ ਜਾਂਦਾ ਹੈ ਤਾਂ ਉੱਥੇ ਮੈਂ ਆਪਣੇ ਹੱਥਾਂ ਦੇ ਨਾਲ ਕੱਪੜੇ ਧੋਂਦਾ ਹਾਂ ਜਿਹੜਾ ਬਹੁਤ ਟਾਈਮ ਖਾ ਜਾਂਦਾ ਹੈ ਮੇਰਾ ਬਟ ਉਹ ਕੱਪੜੇ ਐਨੇ ਵਧੀਆ ਧੁੱਲਦੇ ਹਨ ਜਿਸਦੇ ਕਾਰਨ ਮੈਂ ਆਪਣੇ ਕੱਪੜੇ ਉਹ ਦੋ ਤੋਂ ਤਿੰਨ ਵਾਰ ਪਾ ਸਕਦਾ ਹਾਂ ਜਿਹੜੇ ਮਸ਼ੀਨ 'ਚ ਧੁੱਲਦੇ ਹਨ ਉਹ ਇੱਕ ਜਾਂ ਦੋ ਵਾਰ ਪਾਏ ਹੀ ਜਾਂਦੇ ਹਨ ਪਰ ਜੋ ਹੱਥਾਂ ਨਾਲ ਧੋਏ ਦੀ ਰੀਝ ਹੈ ਉਹ ਹੱਥਾਂ ਦੇ ਧੋਏ ਮਸ਼ੀਨ ਦੇ ਨਾਲ ਨਹੀਂ ਆਉਣੀ ਇਸ ਕਰਕੇ ਮੈਂ ਕੱਪੜੇ ਵੀ ਬਹੁਤ ਦੇਖ ਸਮਝ ਕੇ ਅਤੇ ਜਗ੍ਹਾ ਲੱਭ ਕੇ ਹੀ ਸੁਕਾਉਂਦਾ ਹਾਂ ਅਤੇ ਜਿਸਦੇ ਨਾਲ ਨਾਲ ਮੈਂ ਆਪਣੇ ਹਰ ਚੀਜ਼ ਦਾ ਧਿਆਨ ਰੱਖਦਾ ਹਾਂ ਜੇਕਰ ਧੁੱਪ ਮੇਰੇ ਕਾਲੇ ਕੱਪੜਿਆਂ ਦੇ ਉੱਤੇ ਧੁੱਪਾਂ 'ਚ ਪੈ ਜਾਵੇ ਤਾਂ ਉਹ ਰੰਗ ਵੀ ਉਡਾ ਦਿੰਦੀ ਹੈ ਇਸ ਕਰਕੇ ਮੈਂ ਹੁਣ ਕਾਲੇ ਕੱਪੜੇ ਆਪਣੇ ਸ਼ੈੱਡ ਦੇ ਵਿੱਚ ਹੀ ਸੁਕਾਉਂਦਾ ਹਾਂ ਜਿਸ ਦੇ ਨਾਲ ਨਾਲ ਮੈਂ ਆਪਣੀ ਹਰ ਚੀਜ਼ ਦਾ ਧਿਆਨ ਰੱਖ ਪਾ ਰਿਹਾ ਹਾਂ ਅਤੇ ਹੌਲੀ ਹੌਲੀ ਮੈਂ ਉਹਨਾਂ ਚੀਜ਼ਾਂ ਉੱਤੇ ਗੌਰ ਕਰ ਪਾ ਰਿਹਾ ਹਾਂ ਅਤੇ ਜਿਵੇਂ ਜਿਵੇਂ ਚੱਲਦਾ ਰਹੇਗਾ ਤਾਂ ਮੈਂ ਉਹਨਾਂ ਦਾ ਵੀ ਧਿਆਨ ਰੱਖਾਂਗਾ